ਮੇਰਾ ਮਨਪਸੰਦ ਪੰਜਾਬੀ ਲੇਖਕ ਹੈ ਜਸਵੰਤ ਸਿੰਘ ਕੰਵਲ ਉਹਨਾਂ ਨੇ ਬਹੁਤ ਅੱਛੇ ਅੱਛੇ ਨਾਵਲ ਲਿਖੇ ਹੋਏ ਨੇ ਅਤੇ ਮੈਂ ਜਿਵੇਂ ਕਿ ਜੇਰਾ ਹੋ ਗਿਆ ਲਾਡੋ ਦੀ ਲੋਅ ਅਤੇ ਉਹਨਾਂ ਦਾ ਨਾਵਲ ਇੱਕ ਪੱਖੀ ਜਿਸ ਨੂੰ ਕਿ ਸਾਹਿਤਿਕ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਠੀਕ ਹੈ ਉਹ ਪੜ੍ਹੇ ਨੇ ਅਤੇ ਮੈਨੂੰ ਉਹ ਇਸ ਲਈ ਪਸੰਦ ਨੇ ਕਿਉਂਕਿ ਉਹਨਾਂ ਦਾ ਜੋ ਕਰੈੱਕਟਰ ਨੂੰ ਲੈ ਕੇ ਕਿਰਦਾਰ ਨੂੰ ਲੈ ਕੇ ਜੋ ਬਿਆਨ ਕਰਨ ਦਾ ਤਰੀਕਾ ਹੈ ਉਹ ਬਾ ਕਮਾਲ ਹੈ ਉਹਨਾਂ ਦੀ ਨਾਵਲ ਨੂੰ ਪੜ੍ਹਦੇ ਹੋਏ ਅਸੀਂ ਉਸ ਜਗ੍ਹਾ 'ਤੇ ਉਸ ਸਮੇਂ ਦੇ ਵਿੱਚ ਉਸੇ ਤਰੀਕੇ ਨਾਲ਼ ਪਹੁੰਚ ਜਾਂਦੇ ਹਾਂ ਸੋਚ ਪਾਉਂਦੇ ਹਾਂ ਅਤੇ ਉਹ ਉਹਦੇ ਸਿਰਫ਼ ਕਾਰਨ ਕੀ ਆ ਉਹਨਾਂ ਦੀ ਲਿਖਤ ਅਤੇ ਉਹਨਾਂ ਦੀ ਲਿਖੀ ਹੋਈ ਗੱਲ ਨੂੰ ਸਮਝਾਉਣ ਦਾ ਤਰੀਕਾ ਅਤੇ ਇਕੱਲੀ ਇਕੱਲੀ ਚੀਜ਼ ਨੂੰ ਡੂੰਘਿਆਈ ਦੇ ਨਾਲ਼ ਵਰਣਨ ਕਰਨਾ ਨਾਲ਼ੇ ਤਾਂ ਦ੍ਰਿਸ਼ ਦੱਸਣਾ ਨਾਲ਼ੇ ਗੱਲਬਾਤ ਦੱਸਣੀ ਅਤੇ ਨਾਲ਼ੇ ਵਾਰਤਾਲਾਪ ਅਤੇ ਉਹ ਬਾ ਕਮਾਲ ਕੰਬੀਨੇਸ਼ਨ ਹੈ ਉਹਨਾਂ ਦਾ ਮਤਲਬ ਮੇਲ ਹੈ ਜਿਹਦੇ ਨਾਲ਼ ਉਹਨਾਂ ਦੀਆਂ ਨਾਵਲ ਪੜ੍ਹਨ ਦੇ ਵਿੱਚ ਮੇਰੀ ਰੁਚੀ ਬਹੁਤ ਜ਼ਿਆਦਾ ਹੈ ਅਤੇ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਉਹਨਾਂ ਦੀਆਂ ਨਾਵਲਾਂ